ਸਤਿ ਸ੍ਰੀ ਅਕਾਲ ਮੇਰਾ ਨੈਗਟਿਵ ਪ੍ਰੋਡਕਟ ਹੈਗਾ ਹੈ ਮੈਂ ਇੱਕ ਵਾਰ ਜ਼ਮੈਟੋ ਤੋਂ ਖਾਣਾ ਔਡਰ ਕੀਤਾ ਸੀ ਆਪਣੇ ਬੱਚਿਆਂ ਵਾਸਤੇ ਜਿਹਦੇ ਵਿੱਚ ਮੈਂ ਪੀਜ਼ਾ ਪੁਆਇੰਟ ਤੋਂ ਖਾਣਾ ਔਡਰ ਕੀਤਾ ਸੀ ਜਿਹਦੇ ਵਿੱਚ ਸੀ ਇੱਕ ਦੇ ਨਾਲ ਇੱਕ ਫਰੀ ਅਤੇ ਮੈਂ ਉਹ ਚੀਜ਼ ਦੇਖ ਕੇ ਔਡਰ ਕਰ ਦਿੱਤਾ ਸੀ ਢਾਈ ਸੌ ਰੁਪਏ ਦਾ ਪਰ ਜਦੋਂ ਮੈਨੂੰ ਉਹ ਸਮਾਨ ਮਿਲਿਆ ਉਹਦੇ ਵਿੱਚ ਇੱਕ ਚੀਜ਼ ਹੈ ਸੀ ਔਰ ਦੂਜੀ ਨਹੀਂ ਸੀ ਅਤੇ ਜਦੋਂ ਮੈਂ ਉਸ ਚੀਜ਼ ਦੀ ਕੰਪਲੇਨ ਕੀਤੀ ਕਿ ਵੀ ਤੁਸੀਂ ਮੈਨੂੰ ਕਿਹਾ ਸੀ ਵੀ ਬਾਏ ਵਨ ਗੈਟ ਵਨ ਹੈ ਪਰ ਜਦੋਂ ਇਹ ਆਇਆ ਤਾਂ ਇੱਕ ਪ੍ਰੋਡਕਟ ਤੁਸੀਂ ਖਾਣ ਦੀ ਇੱਕ ਆਈਟਮ ਦਿੱਤੀ ਮੈਨੂੰ ਅਤੇ ਉਹ ਕਹਿੰਦੇ ਕਿ ਮੈਡਮ ਅਸੀਂ ਤੁਹਾਨੂੰ ਦੋ ਪਾ ਕੇ ਦਿੱਤੀਆਂ ਨੇ ਡਿਲੀਵਰੀ ਬੋਆਏ ਨੇ ਵਿੱਚੋਂ ਇੱਕ ਚੀਜ਼ ਕੱਢ ਲਈ ਹੋਣੀ ਹੈ ਅਤੇ ਇਸ ਕਰਕੇ ਅਸੀਂ ਇਹਦੇ ਲਈ ਕੁਛ ਨਹੀਂ ਕਰ ਸਕਦੇ ਤੁਸੀਂ ਪੇਮੈਂਟ ਦੇ ਤੁਸੀਂ ਪੇਮੈਂਟ ਦਿੱਤੀ ਹੈ ਹੁਣ ਤੁਹਾਡੀ ਪੇਮੈਂਟ ਜਿਹੜੀ ਦਿੱਤੀ ਹੋਈ ਪੇਮੈਂਟ ਆ ਉਹ ਵਾਪਿਸ ਨਹੀਂ ਹੋਵੇਗੀ ਅਤੇ ਉਹ ਮੇਰਾ ਜ਼ਿੰਦਗੀ ਦਾ ਸਭ ਤੋਂ ਭੈੜਾ ਅਤੇ ਬੈਡ ਐਕਸਪੀਰੀਅੰਸ ਸੀਗਾ ਕਿ ਖਾਣ ਵਾਲੀਆਂ ਚੀਜ਼ਾਂ ਵਿੱਚ ਵੀ ਲੋਕ ਭੁੱਖ ਖਦਾਉਂਦੇ ਨੇ ਅਤੇ ਆਪਣੀ ਜਿੰਮੇਵਾਰੀ ਨੂੰ ਬਿਲਕੁਲ ਨਹੀਂ ਸਮਝਦੇ ਕਿ ਅਗਲੇ ਨੇ ਮਿਹਨਤ ਦੀ ਕਮਾਈ ਹੁੰਦੀ ਹੈ ਅਤੇ ਅਸੀਂ ਔਨਲਾਈਨ ਬਿਜ਼ਨਸ ਕਰਦੇ ਹਾਂ ਤਾਂ ਥੋੜ੍ਹਾ ਜਿਹਾ ਇਸ ਚੀਜ਼ਾਂ ਦੇ ਪ੍ਰਤੀ ਧਿਆਨ ਦੇਈਏ ਕਿ ਜਿਹੜਾ ਸਾਡਾ ਕਸਟਮਰ ਹੈ ਉਹ ਖ਼ਰਾਬ ਨਾ ਹੋਵੇ ਹੁਣ ਮੈਂ ਇਹ ਚੀਜ਼ ਸੋਚ ਲਈ ਹੈਗੀ ਆਇੰਦਾ ਕਦੀ ਵੀ ਜ਼ਮੈਟੋ ਦੇ ਉੱਤੋਂ ਔਡਰ ਨਹੀਂ ਮੰਗਾਉਣਾ ਇਹਦੇ ਨਾਲੋਂ ਤਾਂ ਆਪਣੇ ਘਰ ਚੀਜ਼ ਬਣਾ ਕੇ ਖਾ ਲਓ ਉਹ ਬੈਟਰ ਹੈਗੀ ਹੈ